ਪੱਚੀ ਜੁਲਾਈ ਉੱਨੀ ਸੌ ਅੱਸੀ ਤੇਈ ਮਾਰਚ ਉੱਨੀ ਸੌ ਉਨਾਸੀ ਗਿਆਰਾਂ ਜੁਲਾਈ ਦੋ ਹਜ਼ਾਰ ਸੱਤ ਅਠਾਈ ਅਗਸਤ ਦੋ ਹਜ਼ਾਰ ਚਾਰ ਇੱਕੀ ਨਵੰਬਰ ਦੋ ਹਜ਼ਾਰ ਤਿੰਨ